ਮੈਂ ਆਪਣੇ ਬਜ਼ੁਰਗਾਂ ਤੋਂ ਇਹ ਸਿੱਖਿਆ ਕਿ ਮੈਂ ਬਚਪਨ ਤੋਂ ਹੀ ਆਪਣੇ ਪੇਕੇ ਘਰ ਵਿੱਚ ਮਹੀਆਂ ਗਾਂਈਆਂ ਬੱਕਰੀਆਂ ਰੱਖਦੇ ਸੀ ਅਸੀਂ ਅਸੀਂ ਉਹਦੇ ਵਿੱਚ ਜਿਹੜੇ ਪਸ਼ੂ ਰੱਖਦੇ ਸਾਂ ਅਸੀਂ ਜਦੋਂ ਪਸ਼ੂ ਸੂਣ ਵਾਲੇ ਹੁੰਦੇ ਸੀ ਜਾਂ ਪਸ਼ੂਆਂ ਦਾ ਸੀ ਇਹ ਧਿਆਨ ਰੱਖਦੇ ਸੀ ਕਿ ਸਾਡੇ ਬਜ਼ੁਰਗ ਸਾਨੂੰ ਦੱਸਦੇ ਸੀ ਬੇਟਾ ਇਹਨਾਂ ਨੂੰ ਸਮੇਂ ਸਿਰ ਖਾਣ ਪੱਠੇ ਪਾਓ ਪਾਣੀ ਪਿਆਓ ਇਹਨਾਂ ਦੀ ਦੇਖਭਾਲ ਕਰੋ ਜੇਕਰ ਕੋਈ ਪਸ਼ੂ ਮੱਝ ਜਾਂ ਬੱਕਰੀ ਜਾਂ ਕੁਛ ਵੀ ਕੋਈ ਢਿੱਲੇ ਮੱਸੇ ਹੋ ਜਾਂਦੇ ਸੀ ਤਾਂ ਅਸੀਂ ਘਰੇ ਹੀ ਉਹਨਾਂ ਨੂੰ ਮਤਲਬ ਕਿ ਜਿਸ ਤਰੀਕੇ ਨਾਲ ਜਿਵੇਂ ਮਤਲਬ ਕਿ ਅਸੀਂ ਉਹਨਾਂ ਨੂੰ ਗੁੱਗਲ ਜਮੈਣ ਦੀ ਧੂਫ ਦੇ ਦੇਣੀ ਉਹਨਾਂ ਨੂੰ ਉਹਨਾਂ ਨੂੰ ਸੰਘਾ ਦੇਣਾ ਉਹਨਾਂ ਦੇ ਨਾਲ ਮਤਲਬ ਉਹਨਾਂ ਨੇ ਪਸ਼ੂਆਂ ਨੂੰ ਕੁਝ ਠੀਕ ਹੋ ਜਾਣਾ ਅਸੀਂ ਉਹਨਾਂ ਦੀ ਦੇਖਭਾਲ ਕਰਨਗੇ ਠੰਡ ਆ ਜਾਣੀ ਤਾਂ ਉਹਨਾਂ ਦੇ ਉੱਪਰ ਮੋਟੇ ਕੰਬਲ ਪੁਰਾਣੇ ਖੇਸ ਉਹਨਾਂ ਦੀ ਢੂਹ ਦੇ ਉੱਤੇ ਦੇ ਦੇਣੇ ਜਿਹੜੇ ਛੋਟੇ ਕੱਟਰੁ ਹੁੰਦੇ ਸੀ ਅਸੀਂ ਉਹਨਾਂ ਜਾਨਵਰਾਂ ਦੀ ਢੂਹ ਦੇ ਉੱਤੇ ਬੋਰੀਆਂ ਛੋਟੀਆਂ ਬੰਨ ਦਿੰਦੇ ਸੀਗੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਮਤਲਬ ਠੰਡ ਤੋਂ ਬਚਾਅ ਲੈਂਦੇ ਸੀਗੇ ਅਸੀਂ ਅਸੀਂ ਬਜ਼ੁਰਗਾਂ ਤੋਂ ਮਤਲਬ ਇਹ ਸਿੱਖਿਆ ਹੈਗਾ ਕਿ ਅਸੀਂ ਘਰ ਪਰਿਵਾਰ ਦੇ ਵਿੱਚ ਸਹੁਰੇ ਪਰਿਵਾਰ 'ਚ ਵੀ ਪੇਕੀ ਪਰਿਵਾਰ 'ਚ ਵੀ ਮੈਂ ਖੁਦ ਜਦੋਂ ਦੀ ਮੇਰੀ ਸੁਰਤ ਸੰਭਲੀ ਅਤੇ ਮੈਂ ਪਸ਼ੂਆਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਪਸ਼ੂ ਨੂੰ ਸੰਭਾਲਿਆ

ਪਸ਼ੂਆਂ ਦੇ ਉੱਤੇ ਮੋਟਰ ਮੋਟੇ ਪੁਰਾਣੇ ਕੰਬਲ ਦੇ ਦੇਣੇ ਅਤੇ ਇਹਨਾਂ ਨੂੰ ਐਸ ਤਰੀਕੇ ਨਾਲ ਸਾਂਭਣਾ ਉਹਨਾਂ ਦੇ ਕੋਲੇ ਥੋੜਾ ਬਹੁਤਾ ਅੱਗ ਬਾਲਣਾ ਔਰ ਬੱਕਰੀ ਬੱਕਰੀਆਂ ਹੁੰਦੀਆਂ ਸੀ ਜਿਹੜੀਆਂ ਜੇਕਰ ਬੱਕਰੀ ਦਾ ਇੱਕ ਆਮ ਜਿਹਾ ਹੈਗਾ ਕਿ ਜੇ ਬਕਰ ਬਕਰੀ ਥੋੜਾ ਜਿਹਾ ਖਾ ਲਵੇ ਨਾ ਵੱਧ ਅਤੇ ਇਸ ਨੂੰ ਅਫਾਰਾ ਹੋ ਜਾਂਦਾ ਇਸ ਕਰਕੇ ਬੱਕਰੀ ਨੂੰ ਨਾ ਮਤਲਬ ਕਿ ਅਸੀਂ ਕਿ ਥੋੜਾ ਜਿਹਾ ਮਿੱਟੀ ਦਾ ਤੇਲ ਲੈ ਕੇ ਕੱਪੜੇ ਨੂੰ ਲਾ ਕੇ ਉਸ ਦੇ ਨੱਕ ਕੋਲੇ ਲਾਇਆ ਜਾਂਦਾ ਸੀ ਤਾਂ ਕਿ ਉਹਦਾ ਫਾਰਾ ਸਕਿਡ ਬਿਲਕੁਲ ਨਾਲ ਦੀ ਨਾਲ ਲਹਿ ਜਾਂਦਾ ਸੀ ਔਰ ਬੱਕਰੀ ਠੀਕ ਹੋ ਜਾਂਦੀ ਸੀ